ਛੋਟੇ ਕਾਰੋਬਾਰ ਉਹ ਕਾਰੋਬਾਰ ਹੁੰਦੇ ਹਨ ਜੋ ਅਸੀਂ ਆਪਣੇ ਘਰ ਵਿੱਚ ਬੈਠ ਕੇ ਘੱਟ ਲਾਗਤ ਵਿੱਚ ਕਰ ਸਕਦੇ ਹਾਂ ਅਤੇ ਜਿਸ ਨੂੰ ਇੱਕ ਹੀ ਘਰ ਦਾ ਮੈਂਬਰ ਹੈਂਡਲ ਕਰ ਸਕਦਾ ਹੋਵੇ ਮੇਰੇ ਖਿਆਲ ਦੇ ਵਿੱਚ ਉਹ ਛੋਟੇ ਕਾਰੋਬਾਰ ਹੁੰਦੇ ਹਨ ਜਿਵੇਂ ਕਿ ਮੈਂ ਆਪਣੇ ਘਰ ਦੇ ਵਿੱਚ ਖੁਦ ਕੱਪੜੇ ਦਾ ਕੰਮ ਕਰਦੀ ਹਾਂ ਔਰ ਮੈਂ ਖੁਦ ਹੀ ਉਹ ਸਭ ਕੁਛ ਹੈਂਡਲ ਕਰਦੀ ਹਾਂ ਮੈਂ ਆਪਣੇ ਘਰ ਦੇ ਵਿੱਚ ਲੇਡੀਜ਼ ਕੁੜਤੀ ਦਾ ਕੰਮ ਕਰਦੀ ਹਾਂ ਅਤੇ ਮੇਰੇ ਕੋਲ ਕੁੜਤੀਆਂ ਲੈਣ ਵੀ ਲੇਡੀਜ਼ ਹੀ ਆਉਂਦੀਆਂ ਹਨ ਅਤੇ ਮੈਂ ਮਤਲਬ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਉਹ ਕੰਮ ਸ਼ੁਰੂ ਕੀਤਾ ਸੀ ਜਿਵੇਂ ਇੱਕ ਮਾਲ ਲੈ ਆਉਂਦੀ ਹਾਂ ਪੇਮੈਂਟ ਜਮ੍ਹਾ ਕਰਾ ਕੇ ਦੂਸਰੀ ਵਾਰ ਲੈ ਆਉਂਦੀ ਹਾਂ ਉੰਨਾ ਕੁ ਮਾਲ ਵੇਚ ਲੈਂਦੀ ਹਾਂ ਮੇਰੇ ਖਿਆਲ ਦੇ ਵਿੱਚ ਇਸ ਇਹਨਾਂ ਨੂੰ ਹੀ ਛੋਟੇ ਕਾਰੋਬਾਰ ਕਿਹਾ ਜਾਂਦਾ ਹੈ ਅਤੇ ਆਪਣੇ ਆਪਣੇ ਕੰਮ ਦੇ ਵਿੱਚ ਹਰ ਬੰਦਾ ਪਰਫੈਕਟ ਹੁੰਦਾ ਹੈ ਜਿਵੇਂ ਕਈ ਵਾਰ ਕਾਰੋਬਾਰ ਦੇ ਵਿੱਚ ਆਪਾਂ ਨੂੰ ਗਾਹਕ ਨੂੰ ਤਸੱਲੀ ਦਵਾਉਣ ਲਈ ਬਹੁਤ ਗੱਲਾਂ ਦੱਸਣੀਆਂ ਕਹਿਣੀਆਂ ਪੈਂਦੀਆਂ ਹਨ ਮੈਂ ਆਪਣੇ 'ਤੇ ਲਾ ਕੇ ਹੀ ਜੇ ਤੁਹਾਨੂੰ ਕਹਾਂ ਤਾਂ ਮੈਂ ਕਈ ਵਾਰ ਲੇਡੀਜ਼ ਨੂੰ ਕਹਿੰਦੀ ਹਾਂ ਕਿ ਇਹ ਕੁੜਤੀ ਬਹੁਤ ਵਧੀਆ ਹੈ ਇਹ ਮੈਂ ਖੁਦ ਲਾ ਰੱਖੀ ਹੈ ਜਾਂ ਇਹ ਮਾਲ ਅਸੀਂ ਵੇਚਤਾ ਇਹਦੇ ਨਾਲ ਦਾ ਮਾਲ ਅਸੀਂ ਚਾਰ ਵਾਰ ਹੋਰ ਮੰਗਵਾਇਆ ਤਾਂ ਇਹ ਸਭ ਗੱਲਾਂ ਕਾਰੋਬਾਰ ਦੇ ਨਾਲ ਇਹ ਰਿਲੇਟਿਡ ਨੇ ਕਹਿਣੀਆਂ ਪੈਂਦੀਆਂ ਨੇ ਗਾਹਕ ਨੂੰ ਤਾਹੀ ਜਾ ਕੇ ਕਾਰੋਬਾਰ ਸੈੱਟ ਹੁੰਦੇ ਨੇਗੇ ਛੋਟੇ ਕਾਰੋਬਾਰ ਹਰ ਬੰਦਾ ਕਰ ਸਕਦਾ ਘਰ ਲਾ ਘੱਟ ਲਾਗਤ ਦੇ ਵਿੱਚ ਛੋਟੇ ਕਾਰੋਬਾਰਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਕੰਮ ਹਨ ਜਿਵੇਂ ਕਿ ਅਸੀਂ ਘਰ ਬੈਠੇ ਲੜਕੀਆਂ ਮਹਿੰਦੀ ਦਾ ਕੰਮ ਕਰ ਸਕਦੀਆਂ ਨੇ ਇਹ ਵੀ ਇੱਕ ਕਾਰੋਬਾਰ ਹੈ ਕੱਪੜੇ ਦਾ ਕੰਮ ਕਰ ਸਕਦੀਆਂ ਨੇ ਲੇਡੀਜ਼ ਬਸਾਤੀ ਦਾ ਕੰਮ ਕਰ ਸਕਦੇ ਹਾਂ ਆਪਾਂ ਘਰ ਬੈਠ ਕੇ ਘੱਟ ਲਾਗਤ ਦੇ ਵਿੱਚ ਕਿਉਂਕਿ ਜੇ ਆਪਾਂ ਘੱਟ ਲਾਗਤ ਦੇ ਵਿੱਚ ਕੰਮ ਕਰਨਾ ਜ਼ਿਆਦਾ ਮਾਲ ਨਾ ਲਿਆਓ ਥੋੜ੍ਹਾ ਮਾਲ ਲੈ ਆਓ ਥੋੜ੍ਹਾ ਜਿਹਾ ਵੇਚ ਲਓ ਹੋਰ ਮਾਲ ਲੈ ਆਓ ਉਹ ਵੇਚ ਲਓ ਇੱਦਾਂ ਕਰਕੇ ਆਪਾਂ ਘਰ ਤੋਂ ਹੀ ਕੰਮ ਸ਼ੁਰੂ ਕਰ ਸਕਦੇ ਹਾਂ